ਇੰਟਰਨੈਟ ਬੈਂਕਿੰਗ ਘੁਟਾਲੇ ਵਧੇਰੇ ਪ੍ਰਚਲਿਤ ਹਨ ਜਿਹਦੇ ਨਾਲ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਹੈ ਪਰ ਅਸੀਂ ਆਨਲਾਈਨ ਬੈ ਬੈਂਕਿੰਗ ਲੈਣ ਦੇਣ ਅਤੇ ਨਿੱਜੀ ਜਾਣਕਾਰੀ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਕਰਨ ਲਈ ਬਹੁਤ ਸਾਰੇ ਉਪਾਏ ਕਰ ਸਕਦੇ ਹਾਂ ਜਿਹਨਾਂ ਤੋਂ ਅਸੀਂ ਕੁਝ ਉਦਾਹਰਨਾਂ ਹੈਗੀਆਂ ਅਸੀਂ ਸਪੈਮ ਜਿਹੜੇ ਈਮੇਲਾਂ ਆਉਂਦੀਆਂ ਉਹਦੇ ਤਾਂ ਅਸੀਂ ਬਚ ਬਚਣ ਲਈ ਸਾਨੂੰ ਕਾਫੀ ਕੁਝ ਕਰਨਾ ਪੈਣਾ ਮਤਲਬ ਉਹ ਇੱਕ ਵਾਇਰਸ ਹੁੰਦਾ ਹੈ ਜਾਂ ਬੈਂਕ ਦੁਆਰਾ ਦੀ ਤ ਤਿਆਰ ਕੀਤੀ ਧੋਖਾ ਵੈਬਸਾਈਟ ਦਾ ਇੱਕ ਲਿੰਕ ਹੁੰਦਾ ਜਿਹਦੇ ਨਾਲ ਮਤਲਬ ਅਸੀਂ ਸਾਡਾ ਜਿਹੜਾ ਡਾਟਾ ਉਹ ਸਕੈਮਰ ਕੋਲ ਪੁੱਜ ਜਾਂਦਾ ਹੈ ਅਤੇ ਦੂਜਾ ਅਸੀਂ ਲੋਗਇਨ ਆਈਡੀ ਪਾਸਵਰਡ ਅਤੇ ਪਿੰਨ ਵਰਗੇ ਵੱਖਰੇ ਨਿਜੀ ਵੇਰਵੇ ਗੁਪਤ ਰੱਖ ਸਕਦੇ ਅਤੇ ਪਾਸਵਰਡ ਟਾਈਮ ਟੂ ਟਾਈਮ ਸਾਨੂੰ ਬਦਲ ਲੈਣਾ ਚਾਹੀਦਾ ਜਿਹੜਾ ਪਾਸਵਰਡ ਸਾਡਾ ਇੰਨਾ ਕੁ ਸਿਕਿਓਰ ਹੋਣਾ ਚਾਹੀਦਾ ਦੂਜੇ ਬੰਦਾ ਜੇ ਉਹ ਦੇਖੇ ਵੀ ਤਾਂ ਵੀ ਉਹਨੂੰ ਪਤਾ ਨਾ ਲੱਗੇ ਅਤੇ ਆਪਣਾ ਪਾਸਵਰਡ ਕਿਸੇ ਵੀ ਨਿੱਜੀ ਬੰਦੇ ਨੂੰ ਅਸੀਂ ਸ਼ੋ ਨਾ ਕਰੀਏ ਤਾਂ ਜੋ ਸਾਡਾ ਉਹ ਕੋਪੀ ਕਰ ਸਕੇ ਜਿਹੜਾ ਆਪਣਾ ਪਾਸਵਰਡ ਸਾਨੂੰ ਸਮੇਂ ਟੂ ਸਮੇਂ ਚੈੱਕ ਕਰਦੇ ਰਹਿਣਾ ਚਾਹੀਦਾ ਕਿ ਕਿਸੇ ਨੂੰ ਪਤਾ ਤਾਂ ਨਹੀਂ ਲੱਗਿਆ ਅਤੇ ਅਸੀਂ ਆਪਣੇ ਲੋਗਇਨ ਐਕਟੀਵਿਟੀ 'ਚ ਦੇਖ ਕੇ ਤਾਂ ਜੋ ਸਾਡੇ ਕੋਲ ਡਾਟਾ ਸਾਡੇ ਕੋਲ ਲੋਗਇਨ ਕਿਸੇ ਹੋਰ ਕੋਲ ਤਾਂ ਨਹੀਂ ਲੋਗਇਨ ਹੈ ਜਿਹੜੇ ਆਪਣਾ ਅਸੀਂ ਖਾਤਾ ਉਹਨੂੰ ਨਿਯਮਿਤ ਚੈੱਕ ਕਰਦੇ ਰਹੀਏ ਤਾਂ ਜੋ ਕੋਈ ਧੋਖਾਧੜੀ ਨਾ ਹੋ ਸਕੇ ਜਿਹੜਾ ਖਾਤਾ ਪਿੰਨ ਦਾ ਧਿਆਨ ਰੱਖੋ ਆਸ ਪਾਸ ਕਿਤੇ ਪਿਆ ਨਾ ਹੋਵੇ ਉਹ ਮਤਲਬ ਕਦੇ ਇੱਧਰ ਉੱਧਰ ਪਿਆ ਹੋਵੇ ਤਾਂ ਜੋ ਸਾਡੇ ਵੀ ਕੋਈ ਚੱਕ ਕੇ ਹੋਰ ਉਦੋਂ ਕੋਈ ਗਲਤ ਮਤਲਬ ਕਰ ਕਰ ਸਕੇ ਹਮੇਸ਼ਾ ਤਾਂ ਸਿੱਧੀ ਬਾਰ ਪੈਡਲੱਖ ਪੱਟੀ ਦੀ ਜਾਂਚ ਕਰੋ ਇਹ ਕਨੈਕਸ਼ਨ ਸੁਰੱਖਿਤ ਹੈ ਵੀ ਕਿ ਨਹੀਂ ਸੁਰੱਖਿਅਤ ਹੈ ਇਹ ਇਹ ਵੀ ਸਲਾਹਾਂ ਦਿੱਤੀ ਜਾਂਦੀਆਂ ਨੇ ਕਿ ਸਾਂਝੇ ਪੀਜੀ 'ਚ ਪੀਜੀ 'ਤੇ ਮਤਲਬ ਕਦੇ ਵੀ ਜਾ ਕੇ ਅਸੀਂ ਆਪਣਾ ਉੱਥੇ ਈਮੇਲ ਡਾਟਾ ਓਨ ਕਰ ਲੈਂਦੇ ਜਾਂ ਬੈਂਕ ਦੀ ਉੱਥੇ ਆਈਡੀ ਲੋਗਿਨ ਕਰਦੇ ਨੈਟ ਬੈਂਕਿੰਗ ਆਨ ਕਰ ਲੈਂਦੇ ਨੇ ਉਹਦੇ ਨਾਲ ਸਾਨੂੰ ਬਾਅਦ 'ਚ ਪ੍ਰੋਬਲਮਾਂ ਸਾਹਮਣਾ ਕਰਨਾ ਪੈ ਸਕਦਾ ਜੇ ਅਸੀਂ ਕਿਤੇ ਲੋਗਿਨ ਵੀ ਕਰ ਲਈਏ ਤਾਂ ਉਹਨੂੰ ਅਸੀਂ ਬਾਅਦ ਵਿੱਚ ਅਸੀਂ ਉਹਨੂੰ ਲੋਗਆਊਟ ਚੱਜ ਨਾਲ ਕਰ ਦਈਏ ਤਾਂ ਜੋ ਕਿਸੇ ਹੋਰ ਕੋਲ ਡਾਟਾ ਉਹ ਨਾ ਪੁੱਜ ਸਕੇ ਨਿੱਜੀ ਕੰਪਿਊਟਰ ਵਿੱਚ ਅਸੀਂ ਕਰੀਏ ਤਾਂ ਜੋ ਉਹ ਵੀ ਕਿਸੇ ਕੋਲੋਂ ਨਾ ਡਾਟਾ ਪੁੱਜ ਸਕੇ ਇਸ ਹਿਸਾਬ ਨਾਲ ਅਸੀਂ ਕਰੀਏ ਉਹਨੂੰ